ਹਾਂਜੀ ਗੁੱਡ ਆਫਟਰਨੂਨ ਮੈਮ ਹਾਂਜੀ ਮੈਂ ਸ਼ੰਕਰ ਗੱਲ ਕਰ ਰਿਹਾ

ਦੇਖੋ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹਦਾ ਕਾਰਨ ਇਹ ਹੈ ਕਿ ਅਨਮਪਲੋਈਮੈਂਟ ਬਹੁਤ ਵੱਧ ਗਈ ਹੈ ਸਾਡੇ ਤਾਂ ਪੂਰੇ ਪੰਜਾਬ 'ਚ ਹੀ ਹੈ ਵੈਸੇ ਤਾਂ ਹੁਸ਼ਿਆਰਪੁਰ ਹੁਸ਼ਿਆਰਪੁਰ 'ਚ ਪੜ੍ਹੇ ਲਿਖੇ ਲੋਕ ਬਹੁਤ ਜ਼ਿਆਦਾ ਨੇ ਜਿਵੇਂ ਇਥੇ ਹੁਸ਼ਿਆਰਪੁਰ ਨੂੰ ਵੈਸੇ ਵੀ ਪੜ੍ਹਿਆ ਲਿਖਿਆ ਦਾ ਸ਼ਹਿਰ ਗਿਆ ਜਾਂਦਾ ਪਰ ਫਿਰ ਵੀ ਐਨੇ ਪੜ੍ਹਿਆਂ ਲਿਖਿਆਂ ਨੂੰ ਨੌਕਰੀ ਦੇ ਬਹੁਤ ਘੱਟ ਸਾਧਨ ਨੇ ਲੋਕਾਂ ਨੂੰ ਨੌਕਰੀ ਨਹੀਂ ਮਿਲ ਰਹੀ ਬੱਚੇ ਪੜ੍ਹਦੇ ਰਹਿੰਦੇ ਨੇ ਅਤੇ ਉਹਨਾਂ ਨੂੰ ਨੌਕਰੀ ਬਾਅਦ 'ਚੋਂ ਦੀ ਉਮੀਦ ਰਹਿੰਦੀ ਨਹੀਂ ਤਾਂ ਇਸ ਕਰਕੇ ਉਹਨਾਂ ਨੂੰ ਹਾਰ ਕੇ ਬਾਹਰ ਜਾਣਾ ਪੈਂਦਾ ਪਰ ਜੇ ਦੇਖਿਆ ਜਾਵੇ ਤਾਂ ਅਨਇੰਪਲੋਏਮੈਂਟ ਤੋਂ ਬਾਹਰਾਂ ਵੀ ਲੋਕ ਦੇਖੋ ਦੇਖੀ ਬਹੁਤ ਬਾਹਰ ਜਾ ਰਹੇ ਨੇ ਜਿਵੇਂ ਕਿ ਸਾਡਾ ਕੋਈ ਗੁਆਂਢੀ ਚਲ ਗਿਆ ਤਾਂ ਆਪਾਂ ਵੀ ਦੇਖ ਕੇ ਉਹਨੂੰ ਜਾਣਾ ਅਤੇ ਇਸ ਤਰ੍ਹਾਂ ਲੋਕ ਕਰਦੇ ਨੇ ਆਪਣਾ ਸਟੇਟਸ ਹਾਈ ਰੱਖਣ ਲਈ ਲੋਕ ਬਾਹਰ ਜਾਣ ਜਾਣਾ ਚਾਹੁੰਦੇ ਹਾਂਜੀ ਹਾਂਜੀ ਇਹ ਮੈਨੂੰ ਤਾਂ ਇਹ ਬਹੁਤ ਗਲਤ ਚੀਜ਼ ਲੱਗਦੀ ਆ ਕਿਉਂਕਿ ਪੰਜਾਬ ਦਾ ਜਿਹੜਾ ਯੂਥ ਆ ਉਹੀ ਆਉਣ ਵਾਲਾ ਫਿਊਚਰ ਯੂਥ ਹੀ ਹੈ ਅਤੇ ਜੇ ਯੂਥ ਹੀ ਨਹੀਂ ਰਹੁਗਾ ਤਾਂ ਪੰਜਾਬ ਦਾ ਕੋਈ ਫਿਊਚਰ ਨਹੀਂ ਪਰ ਇੰਪਲੋਮੈਂਟ ਦੀ ਹੋਣ ਨਾ ਕਰਕੇ ਜਿਹੜਾ ਯੂਥ ਜਿਆਦਾਤਰ ਤਾਂ ਨਸ਼ਿਆਂ ਦੇ ਵਿੱਚ ਵਲਮ ਹੋ ਜਾਂਦਾ ਤਾਂ ਓਸ ਨਾਲ ਵੀ ਨੌਜਵਾਨ ਨੇ ਨੌਜਵਾਨ ਉੱਤੇ ਬਹੁਤ ਫ਼ਰਕ ਪੈਂਦਾ ਜਿਹੜੀ ਨੌਜਵਾਨ ਪਾਪੂਲੇਸ਼ਨ ਆ ਅਤੇ ਇੱਕ ਦੇਖਿਆ ਜਾਵੇ ਤਾਂ ਇਹ ਕੁਛ ਹੱਦ ਤੱਕ ਸਹੀ ਵੀ ਆ ਕੁਛ ਹੱਦ ਤੱਕ ਗਲਤ ਵੀ ਹੈ ਪੰਜਾਬੀ ਕਲਚਰ ਲਈ ਬਹੁਤ ਖ਼ਰਾਬ ਹੈ ਇਹ ਕਿਉਂਕਿ ਜੇ ਯੂਥ ਨਹੀਂ ਰਹੁਗਾ ਤਾਂ ਕਲਚਰ ਸੰਭਾਲਣ ਵਾਲਾ ਕੋਈ ਵੀ ਰਹੁਗਾ ਆਪਾਂ ਵੀ ਦੇਖਿਆ ਕਿ ਬਾਹਰੋਂ ਆ ਕੇ ਲੋਕ ਪੰਜਾਬ ਵਿੱਚ ਰਹਿਣ ਲੱਗ ਪਏ ਨੇ ਜਿਵੇਂ ਨਾਲ ਦੀਆਂ ਸਟੇਟਾਂ ਦੇ ਜਿਹੜੇ ਲੋਕ ਨੇ ਜਿਵੇਂ ਯੂ ਪੀ ਬਿਹਾਰ ਦੇ ਲੋਕ ਨੇ ਉਹ ਪੰਜਾਬ ਵਿੱਚ ਆ ਰਹੇ ਨੇ ਜ਼ਿਆਦਾ ਤੋਂ ਜ਼ਿਆਦਾ ਕੰਮ ਉਹ ਸੰਭਾਲ ਰਹੇ ਨੇ ਜਿੱਥੇ ਕਿ ਸਾਡੇ ਪੰਜਾਬੀਆਂ ਨੂੰ ਓਹ ਕੰਮ ਕਰਨੇ ਚਾਹੀਦੇ ਨੇ

ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਹੁਤ ਸਹੀ ਹੈ ਲੋਕਾਂ ਨੂੰ ਇਰੀ ਇਲੀਗਲ ਤਰੀਕਾ ਬਿਲਕੁਲ ਨਹੀਂ ਯੂਜ ਕਰਨਾ ਚਾਹੀਦਾ ਕਿਉਂਕਿ ਇਸਦੇ ਬਹੁਤ ਨੁਕਸਾਨ ਹੀ ਆ ਲੋਕ ਬਹੁਤ ਮੁਸ਼ਕਿਲ ਨਾਲ ਪਹੁੰਚਦੇ ਨੇ ਉਥੇ ਕਈ ਵਾਰ ਚਾਰ ਮਹੀਨੇ ਕਈ ਵਾਰ ਛੇ ਮਹੀਨੇ ਕਈ ਵਾਰ ਸਾਲ ਹੀ ਲੱਗ ਜਾਂਦੇ ਨੇ ਲੋਕਾਂ ਨੂੰ ਉਥੇ ਪਹੁੰਚਣ ਲਈ ਅਤੇ ਇਸ ਤੋਂ ਬਿਹਤਰ ਆ ਕਿ ਲੋਕ ਆਪਣੇ ਕਾਬਲੀਅਤ ਦੇ ਨਾਲ ਹੀ ਬਾਹਰ ਜਾਣਾ ਆਪਣੇ ਪੜਾਈ ਦੇ ਬੇਸਿਸ 'ਤੇ ਜਾਂ ਕੋਈ ਕੰਮ ਦੇ ਬੇਸਿਸ 'ਤੇ ਰੈਦਰ ਦੈਨ ਕਿ ਇਲੀਗਲੀ ਓਹ ਡੋਂਕੀਆ ਲਾ ਕੇ ਜਾਣ ਬਾਹਰ ਹੋਰ ਰੀਜ਼ਨ ਇਹ ਵੀ ਹੋ ਸਕਦਾ ਕਿ ਲੋਕ ਜਾਂ ਤਾਂ ਇਥੋਂ ਫਿਰ ਬੋਰ ਹੋ ਗਏ ਆ ਜਾਂ ਲੋਕਾਂ ਨੂੰ ਇਥੇ ਇੰਨਾ ਜ਼ਿਆਦਾ ਇੰਟਰਟੇਨਮੈਂਟ ਨਹੀਂ ਹੋ ਰਿਹਾ ਬਾਹਰ ਜਾ ਕੇ ਲੋਕ ਇੱਦਾਂ ਸਮਝਦੇ ਪਏ ਕੀ ਬਾਹਰ ਜਾ ਕੇ ਜਿਆਦਾ ਹਾਂਜੀ ਹਾਂਜੀ ਉਹੀ ਮੈਂ ਦੇਖੋ ਦੇਖੀ ਉਹੀ ਗੱਲ ਕਰ ਰਿਹਾ ਸੀ ਕਿ ਨਸ਼ਿਆਂ ਵੱਲ ਨੌਜਵਾਨ ਜ਼ਿਆਦਾ ਵੱਧ ਰਿਹਾ ਤਾਂ ਉਹਦੇ ਨਾਲ ਉਹਦੇ ਕਰਕੇ ਵੀ ਲੋਕ ਬਾਹਰ ਭੇਜ ਦਿੰਦੇ ਆਪਣੇ ਨਿਆਣਿਆਂ ਨੂੰ ਦੇਖੋ ਜੀ ਮੈਂ ਤਾਂ ਇਹੀ ਕਹੂੰਗਾ ਕਿ ਸਟੂਡੈਂਟਸ ਜਾਂ ਖਾਸ ਆ ਜਿਹੜਾ ਯੂਥ ਆ ਉਹਨਾਂ ਨੂੰ ਪੜ੍ਹਾਈ ਦੇ ਬੇਸਿਸ 'ਤੇ ਜਾਂ ਜਿਹੜੇ ਵਧੀਆ ਕੋਰਸ ਚੁਣ ਕੇ ਬਾਹਰ ਜਾਣਾ ਚਾਹੀਦਾ ਜਿਵੇਂ ਕਿ ਇੰਜੀਨੀਅਰਿੰਗ ਮੈਡੀਕਲ ਫੀਲਡ ਬਹੁਤ ਵਧੀਆ ਬਾਹਰ ਅਤੇ ਇੱਦਾਂ ਦੀ ਫੀਲਡ ਜਿਹਨਾਂ ਵਿੱਚ ਤਰੱਕੀ ਪ੍ਰਾਪਤ ਹੋਏ ਸਨ ਇੱਦਾਂ ਹੀ ਬੇਸਿਕ 'ਤੇ ਜਾਣਾ ਚਾਹੀਦਾ ਸਾਨੂੰ ਨਾ ਕਿ ਕੋਈ ਇਲੀਗਲ ਤਰੀਕੇ ਦਾ ਯੂਸ ਕਰਕੇ ਹਾਂਜੀ ਬਾਕੀ ਉਸ ਤੋਂ ਬਿਹਤਰ ਇਹ ਹੋਉਗਾ ਕਿ ਉਹ ਇੰਡੀਆ ਦੇ ਵਿੱਚ ਹੀ ਰਹਿ ਕੇ ਕੋਸ਼ਿਸ਼ ਕਰਨ ਅਤੇ ਕੁਝ ਬਣ ਕੇ ਦਿਖਾਣ ਅਤੇ ਆਪਣੇ ਇਗਜ਼ਾਮ ਵਗੈਰਾ ਕਲੀਅਰ ਕਰਨ ਗੌਰਮੈਂਟ ਦੇ ਓਕੇ ਜੀ ਹਾਂਜੀ ਵੈਲਕਮ